ਬਹੁਤ ਵਾਰ ਇੱਦਾਂ ਹੁੰਦਾ ਹੈ ਕਿ ਜਦੋਂ ਸਾਡੇ ਕੋਲ ਸਮਾਂ ਘੱਟ ਹੁੰਦਾ ਹੈ ਅਤੇ ਅਸੀਂ ਘੱਟ ਸਮੇਂ ਵਿੱਚ ਬਣਨ ਵਾਲੇ ਭੋਜਨ ਵੱਲ ਹੀ ਜ਼ਿਆਦਾ ਧਿਆਨ ਦਿੰਦੇ ਹਨ ਮੈਂ ਵੀ ਜਦੋਂ ਕੰਮ ਤੋਂ ਲੇਟ ਘਰ ਆਵਾਂ ਉਦੋਂ ਮੈਂ ਘੱਟ ਸਮੇਂ ਵਿੱਚ ਬਣ ਜਾਣ ਵਾਲੀ ਸਬਜ਼ੀ ਵੱਲ ਜ਼ਿਆਦਾ ਧਿਆਨ ਦਿੰਦੀ ਹਾਂ ਜਿਵੇਂ ਕਿ ਮੈਂ ਮੇਰੇ ਤੋਂ ਜਦੋਂ ਸਮਾਂ ਘੱਟ ਹੁੰਦਾ ਹੈ ਤਾਂ ਮੈਂ ਮੈਗੀ ਬਣਾ ਲੈਂਦੀ ਹਾਂ ਕਿਉਂਕਿ ਉਹ ਬਹੁਤ ਹੀ ਜਲਦੀ ਬਣ ਜਾਂਦੀ ਹੈ ਉਹਨੂੰ ਸਿਰਫ ਪਾਣੀ ਵਿੱਚ ਉਬਾਲਣਾ ਹੁੰਦਾ ਹੈ ਅਤੇ ਉਹ ਬਹੁਤ ਹੀ ਮਿੰਟਾਂ ਸਕਿੰਟਾਂ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਕਈ ਵਾਰ ਮੈਂ ਪਾਸਤਾ ਬਣਾ ਲੈਂਦੀ ਹਾਂ ਕਿਉਂਕਿ ਉਹਨੂੰ ਵੀ ਸਿਰਫ ਉਬਾਲ ਕੇ ਅਤੇ ਤੜਕੇ ਵਿੱਚ ਪਾ ਦੇਣਾ ਹੈ ਅਤੇ ਉਹ ਵੀ ਬਹੁਤ ਹੀ ਵਧੀਆ ਤਿਆਰ ਹੋ ਜਾਂਦਾ ਹੈ ਅਤੇ ਉਹਨੂੰ ਵੀ ਬਹੁਤ ਘੱਟ ਸਮੱਗਰੀ ਲੱਗਦੀ ਹੈ ਅਤੇ ਕਈ ਵਾਰ ਮੈਂ ਦਲੀਆ ਅਤੇ ਖਿਚੜੀ ਬਣਾ ਲੈਂਦੀ ਹਾਂ ਉਹ ਵੀ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦਾ ਹੈ ਅਤੇ ਉਹਨੂੰ ਸਮਾਂ ਵੀ ਬਹੁਤ ਘੱਟ ਲੱਗਦਾ ਹੈ ਮੇਰੇ ਤੋਂ ਜਦੋਂ ਵੀ ਸਮਾਂ ਘੱਟ ਹੁੰਦਾ ਹੈ ਤਾਂ ਮੈਂ ਹਮੇਸ਼ਾਂ ਹੀ ਦਲੀਆ ਜਾਂ ਖਿਚੜੀ ਬਣਾਉਂਦੀ ਹਾਂ ਕਿਉਂਕਿ ਉਹ ਬਹੁਤ ਹੀ ਹੈਲਥੀ ਆ ਅਤੇ ਉਹਨੂੰ ਖਾ ਬਣਾਉਣਾ ਅਤੇ ਖਾਣਾ ਵੀ ਬਹੁਤ ਹੀ ਸੌਖਾ ਹੈ ਖਿਚੜੀ ਨੂੰ ਬਣਾਉਣ ਦਾ ਬਹੁਤ ਹੀ ਸੌਖਾ ਤਰੀਕਾ ਹੈ ਉਹਨੂੰ ਸਿਰਫ ਉਬਾਲਣਾ ਹੈ ਅਤੇ ਉਹ ਬਣ ਕੇ ਤਿਆਰ ਹੋ ਜਾਂਦੀ ਹੈ ਦਲੀਏ ਵਿੱਚ ਵੀ ਸਿਰਫ ਦੁੱਧ ਪੈਂਦਾ ਹੈ ਅਤੇ ਉਹ ਵੀ ਬਣ ਕੇ ਤਿਆਰ ਹੋ ਜਾਂਦਾ ਹੈ ਇਹ ਦੋਵੇਂ ਚੀਜ਼ਾਂ ਹੀ ਬਹੁਤ ਸਮੇਂ ਘੱਟ ਅਤੇ ਸਮੱਗਰੀ ਘੱਟ ਵਿੱਚ ਹੀ ਬਣ ਕੇ ਤਿਆਰ ਹੋ ਜਾਂਦੀਆਂ ਹਨ ਜਦੋਂ ਵੀ ਮੇਰੇ ਕੋਲ ਸਮਾਂ ਘੱਟ ਹੁੰਦਾ ਹੈ ਮੈਂ ਉਦੋਂ ਮਸਰਾਂ ਦੀ ਦਾਲ ਨੂੰ ਹੀ ਤੜਕਾ ਲਾ ਲੈਂਦੀ ਹੈ ਕਿਉਂਕਿ ਉਹ ਸਿਰਫ ਇੱਕ ਦੋ ਸੀਟੀਆਂ ਵਿੱਚ ਹੀ ਬਣ ਕੇ ਤਿਆਰ ਹੋ ਜਾਂਦੀ ਹੈ ਇੱਦਾਂ ਕਰਕੇ ਮੈਂ ਸਮੇਂ ਘੱਟ ਵਾਲੀਆਂ ਸਬਜ਼ੀਆਂ ਨੂੰ ਹੀ ਬਣਾ ਕੇ ਤਿਆਰ ਕਰ ਲੈਂਦੀ ਹਾਂ